ਸਾਡੇ ਦੇਸ਼ ਵਿੱਚ ਡਾਂਸਰਾਂ ਨੂੰ ਉਹ ਦਰਜਾ ਨਹੀਂ ਮਿਲਦਾ ਜਿਹੜਾ ਕਿ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਇਸ ਲਈ ਡਾਂਸਰਾਂ ਨੂੰ ਸਭ ਤੋਂ ਪਹਿਲਾਂ ਤਾਂ ਇਹ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਉਹਨਾਂ ਨੂੰ ਵਧੀਆ ਦਰਜਾ ਦਿੱਤਾ ਜਾਵੇ ਤਾਂ ਕਿ ਉਹ